ਹਾਂਜੀ ਮੈਂ ਇਹ ਮੀਟਿੰਗ ਵਿੱਚ ਬਹੁਤ ਵਾਰੀ ਹਿੱਸਾ ਲਿਆ ਕਿਉਂਕਿ ਮੈਂ ਇੱਕ ਟੀਚਰ ਹਾਂ ਟੀਚਰ ਹੋਣ ਦੇ ਕ ਬਾਵਜੂਦ ਜਦੋਂ ਕਰੋਨਾ ਟਾਈਮ ਦੇ ਵਿੱਚ ਅਸੀਂ ਕੋਈ ਵੀ ਮੀਟਿੰਗ ਵਗੈਰਾ ਹੁੰਦੀ ਤਾਂ ਅਸੀਂ ਵੀਡੀਓ ਕੋਨਫਰੈਂਸ ਨਾਲ ਕਰਦੇ ਜਾਂ ਅਸੀਂ ਔਨਲਾਈਨ ਮੀਟਿੰਗ ਕਰਦੇ ਇਹਦੇ ਨਾਲ ਕੀ ਹੈ ਤਜ਼ਰਬਾ ਕੀ ਹੁੰਦਾ ਵੀ ਅਸੀਂ ਬਹੁਤ ਸਾਰੇ ਟੀਚਰ ਆਪਸ ਦੇ ਵਿੱਚ ਬੈਠੇ ਗੱਲਾਂ ਸ਼ੇਅਰ ਕਰਦੇ ਹਾਂ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਕਰੋਨਾ ਦੇ ਟਾਈਮ ਦੇ ਵਿੱਚ ਜਦੋਂ ਬਾਹਰ ਜਾਣਾ ਅਲਾਊਡ ਨਹੀਂ ਸੀਗਾ ਤਾਂ ਕੋਈ ਵੀ ਡਿਸਕਸ਼ਨ ਕਰਨਾ ਹੁੰਦਾ ਬੱਚਿਆਂ ਦੀ ਸਟੱਡੀ ਨਾਲ ਰਿਲੇਟਡ ਡਿਸਕਸ਼ਨ ਕਰਨ ਦਾ ਤਾਂ ਕਿ ਕਰਦੇ ਇਹ ਔਨਲਾਈਨ ਜਿਹੜਾ ਵੀਡੀਓ ਕਾਨਫਰਸਿੰਗ ਕਾਲ ਹੁੰਦੀ ਹੈ ਇਹ ਬਹੁਤ ਬੈਨੀਫਿਟ ਰਹੀ ਹੈ ਇਹ ਮੈਨੂੰ ਬਹੁਤ ਪਸੰਦ ਹੈ ਅਸੀਂ ਜਦੋਂ ਕਿਸੇ ਪੇਰੈਂਟਸ ਦੇ ਘਰ ਨਹੀਂ ਜਾ ਸਕਦੇ ਜਾਂ ਬੱਚੇ ਬਾਰੇ ਕੋਈ ਨੋਲੇਜ ਲੈਣੀ ਹੁੰਦੀ ਹੈ ਤਾਂ ਵੀਡੀਓ ਕੋਨਫਰਸਿੰਗ ਕਰਦੇ ਹਾਂ ਜਿਹਦੇ ਨਾਲ ਬੱਚੇ ਵੀ ਜੁੜਦੇ ਨੇ ਅਸੀਂ ਟੀਚਰ ਵੀ ਜੁੜਦੇ ਹਾਂ ਇਹਦੇ ਨਾਲ ਸਾਨੂੰ ਬੱਚਿਆਂ ਬਾਰੇ ਟਾਈਮ ਟੂ ਟਾਈਮ ਨਿਊਜ਼ ਮਿਲਦੀ ਰਹਿੰਦੀ ਹੈ ਵੀ ਬੱਚੇ ਸਟੱਡੀ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਇਹ ਇੱਕ ਬਹੁਤ ਹੀ ਸੌਖਾ ਅਤੇ ਵਧੀਆ ਤਰੀਕਾ ਹੈ ਇਹਦੇ ਨਾਲ ਕੀ ਆ ਨਾ ਹੀ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਪੈਂਦੀ ਹੈ ਅਸੀਂ ਕਿਤੇ ਵੀ ਬੈਠ ਕੇ ਕਿਤੇ ਵੀ ਕਾਲ ਕਰ ਸਕਦੇ ਹਾਂ ਇੱਕ ਈਵਨ ਕਿ ਇੱਕ ਕੰਟਰੀ ਤੋਂ ਲੈ ਕੇ ਦੂਸਰੀ ਕੰਟਰੀ ਵਿੱਚ ਵੀ ਅਸੀਂ ਕਾਲ ਕਰ ਸਕਦੇ ਹਾਂ ਉੱਥੋਂ ਦਾ ਸਭ ਕੁਛ ਦੇਖ ਸਕਦੇ ਹਾਂ ਵਿਊ ਵੀ ਦੇਖ ਸਕਦੇ ਹਾਂ ਵੀ ਉੱਥੋਂ ਦਾ ਕੀ ਵਿਊ ਆ ਕੀ ਐਟਮੋਸਫੇਅਰ ਹੈ ਤਾਂ ਕਰਕੇ ਕੀ ਆ ਇਹ ਮੈਨੂੰ ਬਹੁਤ ਪਸੰਦ ਹੈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਔਨਲਾਈਨ ਕੁਛ ਵੀ ਆਪਾਂ ਵੀਡੀਓ ਕਾਲ ਵੀਡੀਓ ਕਾਲ ਨਾਲ ਬੈਠ ਕੇ ਸਾਰਾ ਕੁਛ ਦੇਖ ਸਕਦੇ ਹਾਂ